ਮੇਰੇ ਕੋਲ ਹੰਨੇ ਹੰਨੇ ਪਾਤਸ਼ਾਹੀ ਤੇ ਚੜ੍ਹਦੀ ਕਲਾ ਦੀ ਕਿਤਾਬ ਹੈ ਜੋ ਮੈਂ ਪੜ੍ਹੀ ਹੈ ਤੇ ਸਾਡੇ ਧਾਰਮਿਕ ਸੱਭਿਆਚਾਰ ਦੇ ਵਿੱਚ ਫਿਲਮ ਨਹੀਂ ਬਣਾਈ ਜਾਂਦੀ ਜੇ ਬਣਾਉਣਾ ਚਾਹੁੰਦੇ ਹਾਂ ਤਾਂ ਉਹ ਕਾਟਰੂਨ ਥਰੂ ਬਣਦੀ ਹੈ ਅਤੇ ਬਾਕੀ ਜਿਹੜਾ ਸਾਡਾ ਪੰਜਾਬੀ ਸੱਭਿਆਚਾਰ ਹੈ ਜਾਂ ਪੰਜਾਬੀ ਸਾਡਾ ਅ ਗੁਰਸਿੱਖ ਇਤਿਹਾਸ ਹੈ ਉਹਦੇ ਵਿੱਚ ਗੁਰੂ ਸਾਹਿਬ ਦੀ ਮਰਿਆਦਾ ਅਨੁਸਾਰ ਹੀ ਸਾਰੇ ਕੰਮ ਕੀਤੇ ਜਾਂਦੇ ਨੇ ਜਿਵੇਂ ਕਿ ਸਾਡੇ ਇਤਿਹਾਸ ਦੇ ਵਿੱਚ ਸਾਡੇ ਪੰਜਾਬੀ ਸੱਭਿਆਚਾਰ ਦੇ ਵਿੱਚ ਧਾਰਮਿਕ ਦੇ ਵਿੱਚ ਫਿਲਮ ਨਹੀਂ ਬਣਾਈ ਜਾਂਦੀ